ਟਰੈਕਿੰਗ ਕੋਟ ਨੂੰ ਪਹਾੜੀ ਇਲਾਕੇ ਵਿੱਚ ਟਰੈਕਿੰਗ ਕਰਦੇ ਵਕਤ ਵਰਤਿਆ ਜਾਂਦਾ ਹੈ ਟਰੈਕਿੰਗ ਕਰਦੇ ਵਕਤ ਇਸ ਦੀ ਬੜੀ ਮਹੱਤਤਾ ਹੈ ਕਿਉਂਕਿ ਇਸਨੂੰ ਟੇਡਾ ਔਰ ਛੋਟਾ ਵੀ ਕਰ ਸਕਦੇ ਹੈ ਚੜ੍ਹਾਈ ਕਰਨ ਦੇ ਦੌਰਾਨ ਇਸਦੀ ਬਹੁਤ ਵਰਤੋਂ ਨਾਲ ਸਾਡੇ ਗੋਡਿਆਂ 'ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ ਪੋਲ ਸੰਤੁਲਨ ਬਣਾਉਣ ਲਈ ਯੋਗਦਾਨ ਪੈਦਾ ਹੈ ਆਪਣੇ ਪਰਿਵਾਰ ਦੇ ਨਾਲ ਮੈਂ ਘੁੰਮਣ ਲਈ ਪਹਾੜੀਆਂ ਵਿੱਚ ਗਈ ਸੀ ਉਸ ਵਕਤ ਉਸ ਵਕਤ ਕਰਾਏ 'ਤੇ ਬੂਟ ਔਰ ਕੋਟ ਦੇ ਨਾਲ ਟ੍ਰੇਨਿੰਗ ਪੋਲ ਵੀ ਮਿਲੀ ਉਸ ਵਕਤ ਇਸ ਦੀ ਵਰਤੋਂ ਨਾਲ ਪਹਾੜ ਚੜ੍ਹਨਾ ਸੌਖਾ ਹੋ ਗਿਆ ਇਸ ਦੀ ਟ੍ਰੇਨਿੰਗ ਕਰਦੇ ਵਕਤ ਬਹੁਤ ਜ਼ਰੂਰਤ ਪੈਂਦੀ ਹੈ ਹੋਰ ਚੀਜ਼ਾਂ ਬਹੁਤ ਵਰਤਣ ਦੇ ਨਾਲ ਯਾਤਰਾ ਬਹੁਤ ਆਸਾਨ ਹੋ ਜਾਂਦੀ ਹੈ ਟ੍ਰੇਨਿੰਗ ਪੋਲ ਦੇ ਹੱਥ ਵਿੱਚ ਫੜ ਕੇ ਸਹਾਰੇ ਵਾਂਗ ਵਰਤਿਆ ਜਾਂਦਾ ਹੈ